ਪੰਜਾਬ ਵਿੱਚ ਕਾਰੋਬਾਰ ਆਪਣੇ ਸੰਚਾਲਨ ਅਤੇ ਉਤਪਾਦਨਾਂ ਨੂੰ ਬਿਹਤਰ ਬਣਾਉਣ ਲਈ ਕਾਫ਼ੀ ਚੀਜ਼ਾਂ ਕਰਦੇ ਹਨ ਜਿੱਦਾਂ ਇੱਕ ਤਾਂ ਮੇਨ ਐਡਵਰਟੀਜਮੈਂਟ ਹੀ ਹੋ ਗਈ ਜਿਵੇਂ ਅੱਜ ਕੱਲ੍ਹ ਦੀਆਂ ਸੋਸ਼ਲ ਮੀਡੀਆ ਉੱਤੇ ਜਾਣਾ ਟੈਕਨੋਲੋਜੀ ਯੂਜ ਕਰਨਾ ਵਿੱਚ ਕੀ ਕਹਿੰਦੇ ਆ ਆਪਣੀਆਂ ਵੱਖਰੀਆਂ ਵੱਖਰੀਆਂ ਆਪਣੇ ਆਪਣੇ ਸਮਾਨ ਜਿਹੜੇ ਵੇਚਦੇ ਪਏ ਹਨ ਜਿਹੜਾ ਜਿਸ ਚੀਜ਼ ਦਾ ਬਿਜ਼ਨਸ ਹੈਗਾ ਉਸ ਚੀਜ਼ ਦਾ ਫੋਟੋਆਂ ਪਾਉਣਾ ਉਸ ਚੀਜ਼ ਦੀਆਂ ਵੱਖਰੀਆਂ ਵੱਖਰੀਆਂ ਵੀਡੀਓ ਬਣਾਉਣਾ ਜਿਹਦੇ ਨਾਲ ਲੋਕ ਸਪੈਸ਼ਲੀ ਆਉਂਦੇ ਆ ਵੇਖਦੇ ਆ ਵੀਡੀਓ ਅਤੇ ਖੁਸ਼ ਹੋ ਕੇ ਵੇਖਦੇ ਹਨ ਅਤੇ ਨਾਲੇ ਦੇਖਦੇ ਕਿ ਕਿੱਧਰ ਹੈਗੀ ਕਾਰੋਬਾਰ ਕਿੱਧਰ ਹੈਗਾ ਅਤੇ ਲੋਕ ਸਪੈਸ਼ਲੀ ਆਉਂਦੇ ਹਨ ਉੱਧਰ ਵੀ ਸਮਾਨ ਸਮੂਨ ਖਰੀਦਣ ਵਾਸਤੇ ਜਾਂ ਔਨਲਾਈਨ ਔਡਰ ਕਰਦੇ ਹਨ ਔਨਲਾਈਨ ਆਪਣਾ ਸਾਰਾ ਬਿਜ਼ਨਸ ਪਾਉਂਦੇ ਹਨ ਲੋਕ ਪੰਜਾਬੀ ਲੋਕ ਵੀ ਹੁਣ ਕਿ ਜਿਵੇਂ ਉਹਨਾਂ ਦਾ ਕੋਈ ਪ੍ਰੋਡਕਟ ਹੋਇਆ ਅਤੇ ਉਹਨੂੰ ਔਨਲਾਈਨ ਵੈਬਸਾਈਟਾਂ ਵਗੈਰਾ ਬਣਾ ਬਣੂ ਕੇ ਉੱਥੇ ਪਾਉਂਦੇ ਹਨ ਤਾਂ ਕਿ ਵੀ ਲੋਕ ਵੇਖੇ ਅਤੇ ਉੱਥੇ ਹੀ ਔਡਰ ਕਰ ਦੇਈਏ ਅਤੇ ਅਸੀਂ ਬਸ ਸਾਡਾ ਸਾਰਾ ਸਮਾਨ ਬਣਾ ਕੇ ਡਿਲੀਵਰ ਕਰਨ ਦਾ ਕੰਮ ਹੋਵੇ ਇਹ ਕੰਮ ਹੋ ਗਿਆ ਅਤੇ ਔਨਲਾਈਨ ਚੀਜ਼ਾਂ ਜਿਵੇਂ ਕੀ ਆ ਕੰਮ ਛੇਤੀ ਕਰਨਾ ਲੋਕਾਂ ਨੂੰ ਕੀ ਏ ਨਾਮ ਹੈ ਸਾਡੇ ਦੇਸ਼ ਵਾਸਤੇ ਕੁਝ ਚੀਜ਼ਾਂ ਪਾਉਣਾ ਤਾਂ ਕੀ ਲੋਕ ਵੇਖੇ ਅਤੇ ਵੇਖਣ ਉਹਨੂੰ ਕੀ ਕਹਿੰਦੇ ਸਾਡੇ ਦੇਸ਼ ਵਿੱਚ ਜਿੱਦਾਂ ਕਰਕੇ ਉਹਨੂੰ ਸੋਸ਼ਲ ਮੀਡੀਆ 'ਤੇ ਪਾਉਣਾ ਜਾਂ ਉਹਦੀਆਂ ਫੋਟੋਆਂ ਪਾਉਣਾ ਉਹਦੀਆਂ ਵੀਡੀਓ ਪਾਉਣਾ ਜਿਹਦੇ ਨਾਲ ਲੋਕ ਵੇਖੇ ਅਤੇ ਖੁਸ਼ ਹੋਣ ਕਿ ਨਾ ਲੋਕ ਸਿਰਫ਼ ਕਿ ਬਿਜ਼ਨਸ ਨਹੀਂ ਕਰਦੇ ਪਏ ਨਾਲ ਸਾਡੇ ਦੇਸ਼ ਵਾਸਤੇ ਵੀ ਵਧੀਆ ਕੰਮ ਕਰਦੇ ਪਏ ਜਿਹਦੇ ਜਿਹੜਾ ਉਹ ਪੈਸਾ ਪਾਉਂਦੇ ਹਨ ਕਿ ਇਹ ਸਮਾਨ ਖਰੀਦਣ ਵਿੱਚ ਉਹ ਕਿਤੇ ਹੋਰ ਯੂਸ ਵੀ ਹੁੰਦਾ ਪਿਆ ਵਾ ਅਤੇ ਇਹਦੇ ਨਾਲ ਕੀ ਆ ਦੇਸ਼ ਦਾ ਦੇਸ਼ ਵੀ ਵਧੀਆ ਹੁੰਦਾ ਜਾ ਇਹ ਸਾਡੀ ਕੀ ਹੈ ਪੰਜਾਬ ਦੀ ਪੰਜਾਬ ਵੀ ਹੋਰ ਉੱਗਦਾ ਵਾ